ਦੇਖੋ ਅੰਮ੍ਰਿਤਾ ਪ੍ਰੀਤਮ ਜੀ ਦਾ ਜਿਹੜੀ ਇਹ ਰਚਨਾ ਹੈ ਮਨ ਮਿਰਜ਼ਾ ਤਨ ਸਾਹਿਬਾਂ ਉਹ ਮੈਨੂੰ ਬਹੁਤ ਹੀ ਦਿਲੀ ਤੌਰ 'ਤੇ ਬਹੁਤ ਅੱਛੀ ਲੱਗਦੀ ਹੈ ਬਹੁਤ ਪਸੰਦ ਹੈ ਅਗਰ ਤੁਸੀਂ ਇਸ ਦੇ ਨਾਮ ਜਾਂ ਇਸ ਨੂੰ ਪੜ੍ਹੋ ਤਾਂ ਇਹਦੇ ਵਿੱਚ ਜੋ ਭਾਵਨਾ ਹੈ ਉਹ ਭਾਵਨਾ ਇਸ ਪ੍ਰਕਾਰ ਦੀ ਹੈ ਕਿ ਮਿਰਜ਼ਾ ਇੱਕ ਮਨ ਹੈ ਜਿਹੜਾ ਸਾਹਿਬਾਂ ਦੇ ਤਨ ਦੇ ਵਿੱਚ ਵੱਸਦਾ ਹੈ ਤੋ ਮਿਰਜ਼ਾ ਔਰ ਸਾਹਿਬਾਂ ਜਿਹੜੇ ਨੇ ਉਹ ਅਲੱਗ ਨਹੀਂ ਕੀਤੇ ਜਾ ਸਕਦੇ ਇਹ ਭਾਵਨਾ ਆਪਣੇ ਆਪ ਦੇ ਵਿੱਚ ਜਿਹੜੀ ਹੈ ਨਾ ਇੱਕ ਬਹੁਤ ਹੀ ਉਚੇਰੇ ਉਚੇਰੀ ਮੁਹੱਬਤ ਦੇ ਖਿਆਲ ਨੂੰ ਜਿਹੜੀ ਹੈ ਪ੍ਰਗਟ ਕਰਦੀ ਹੈ ਇਸ ਤੋਂ ਇਲਾਵਾ ਆਪਣੀ ਇਸ ਰਚਨਾ ਦੇ ਵਿੱਚ ਉਹਨਾਂ ਨੇ ਆਪ ਲਿਖੀਆਂ ਹੋਈਆਂ ਕੁਛ ਨਜ਼ਮਾਂ ਵੀ ਪੇਸ਼ ਕੀਤੀਆਂ ਹਨ ਉਹ ਨਜ਼ਮਾਂ ਦਾ ਜਦੋਂ ਆਪਾਂ ਤੱਥ ਕੱਢਦੇ ਹਾਂ ਮਤਲਬ ਕੱਢਦੇ ਹਾਂ ਤਾਂ ਮੁਹੱਬਤ ਨੂੰ ਕਿਸ ਰੂਹਾਨੀਅਤ ਦੇ ਨਾਲ ਜੋੜਿਆ ਜਾ ਸਕਦਾ ਹੈ ਉਸ ਰੂਹਾਨੀਅਤ ਦੀ ਗੱਲ ਅੰਮ੍ਰਿਤਾ ਪ੍ਰੀਤਮ ਜੀ ਨੇ ਆਪਣੀ ਇਸ ਰਚਨਾ ਦੇ ਵਿੱਚ ਕੀਤੀ ਹੈ ਜਿਸ ਡੁੰਗਾਈ ਦੇ ਵਿੱਚ ਜਾ ਕੇ ਰੂਹਾਂ ਤੱਕ ਦੇ ਪਿਆਰ ਨੂੰ ਇੱਕ ਦੂਜੇ ਦੇ ਨਾਲ ਜੋੜਨਾ ਇਹ ਇਹ ਬਹੁਤ ਘੱਟ ਤਰ੍ਹਾਂ ਦੇ ਐਸੀਆਂ ਰਚਨਾਵਾਂ ਨੇ ਅਲੱਗ ਅਲੱਗ ਰਚਨਾਕਾਰਾਂ ਦੀਆਂ ਜਿਹੜੀਆਂ ਇਸ ਇਸ ਇੱਕ ਪੜਾਵ ਤੱਕ ਇਸ ਲਿਮਿਟ ਤੱਕ ਪਹੁੰਚਦੀਆਂ ਹਨ ਤੋ ਇਸ ਵਜ੍ਹਾ ਕਰਕੇ ਮੈਨੂੰ ਇਹਨਾਂ ਦੀ ਹੀ ਰਚਨਾ ਜਿਹੜੀ ਹੈ ਉਹ ਸਭ ਤੋਂ ਜ਼ਿਆਦਾ ਮੇਰੇ ਦਿਲ ਨੂੰ ਛੂਹੰਦੀ ਹੈ ਧੰਨਵਾਦ